ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲ਼ ਰਹੇ ਆ ਹਾਂਜੀ ਹਾਂਜੀ ਬੋਲ਼ ਰਹੇ ਆ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਇੱਥੇ ਪੂਰੀ ਸੁਵਿਧਾ ਹੈ ਜਿਵੇਂ ਜਿਵੇਂ ਵੀ ਤੁਸੀਂ ਹਾਂਜੀ ਹਾਂ ਮੈਮ ਜਦੋਂ ਤੁਸੀਂ ਇੱਕ ਵਾਰ ਸਾਡੇ ਢਾਬੇ ਚੈਕਿੰਗ ਕਰ ਲਿਆ ਤੁਹਾਨੂੰ ਖਾਣ ਪੀਣ ਨੂੰ ਘੁੰਮਣ ਫਿਰਨ ਨੂੰ ਤੁਹਾਨੂੰ ਟ੍ਰਾਸਪੋਰਟ ਦੀ ਵੀ ਪੂਰੀ ਸਹੂਲਤ ਮਿਲੂਗੀ ਨਹੀਂ ਨਹੀਂ ਮੈਮ ਤੁਸੀਂ ਬੇਫਿਕਰ ਰਹੋ ਤੁਸੀਂ ਬੇਫਿਕਰ ਰਹੋ ਮੈਮ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਊਗੀ ਜੋ ਵੀ ਲੋਕਲ ਤੁਹਾਡੇ ਘੁੰਮਣ ਫਿਰਨ ਨੂੰ ਹੋਊਗਾ ਤੁਹਾਨੂੰ ਸਭ ਕੁੱਝ ਮਿਲੂਗਾ ਹਾਂਜੀ ਹਾਂਜੀ ਹਾਂਜੀ ਮੈਮ ਬਿਲਕੁਲ ਜਿੱਥੇ ਵੀ ਤੁਸੀਂ ਘੁੰਮਣਾ ਹੋਊਗਾ ਤੁਹਾਨੂੰ ਨਾਲ ਲੈ ਕੇ ਘੁੰਮਾਇਆ ਜਾਏਗਾ ਅਤੇ ਸਭ ਕੁੱਝ ਤੁਹਾਨੂੰ ਗਾਈਡ ਕੀਤਾ ਜਾਵੇਗਾ ਜਿੱਥੇ ਵੀ ਤੁਸੀਂ ਘੁੰਮਣਾ ਫਿਰਨਾ ਹੋਊਗਾ ਤੁਹਾਨੂੰ ਸਾਰਾ ਦੱਸੇਗਾ ਜਿਹੜੇ ਵੀ ਫੇਮਸ ਚੀਜ਼ਾਂ ਨੇ ਇਥੇ ਤੁਹਾਡੇ ਤੁਹਾਡੇ ਨਾਲ ਜਾ ਕੇ ਸਾਰੇ ਪਾਸੇ ਘੁੰਮਾਇਆ ਜਾਏਗਾ ਤੁਹਾਨੂੰ ਹਾਂਜੀ ਮੈੈਮ ਉਹ ਤੁਹਾਡੀ ਆਪਣੀ ਇੱਛਾ ਹੈ ਜੇਕਰ ਤੁਸੀਂ ਔਨਲਾਈਨ ਬੁਕਿੰਗ ਕਰੋਗੇ ਤਾਂ ਤੁਹਾਨੂੰ ਤੁਹਾਨੂੰ ਹੀ ਸਹੂਲਤ ਹੋਊਗੀ ਜਿਵੇਂ ਕਿ ਰੂਮਜ਼ ਵਗੈਰਾ ਜੇ ਅਵੈਲੇਵਲ ਹੋਏ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਭੀੜ ਜ਼ਿਆਦਾ ਹੋ ਜਾਂਦੀ ਹੈ ਕਿ ਫੇਰ ਕਈ ਵਾਰ ਸਾਨੂੰ ਇਥੇ ਆ ਕੇ ਰੂਮ ਨਾ ਮਿਲੇ ਅਤੇ ਜੇਕਰ ਤੁਸੀਂ ਔਨਲਾਈਨ ਬੁਕਿੰਗ ਕਰੋਗੇ ਤਾਂ ਤੁਹਾਨੂੰ ਫਾਇਦਾ ਹੀ ਹੋਊਗਾ ਮੈਮ ਪੰਜ ਸੌ ਰੁਪਏ ਐਕਸਟਰਾ ਲੱਗੇਗਾ ਜੀ ਔਨਲਾਈਨ ਬੁਕਿੰਗ 'ਤੇ ਹਾਂਜੀ ਬੱਸ ਹਾਂਜੀ ਤਾਂ ਇੱਕ ਇੱਕ ਰੂਮ ਦਾ ਪੰਦਰਾਂ ਸੌ ਰੁਪਈਆ ਹੈ ਟੋਟਲ ਦੋ ਹਜ਼ਾਰ ਹੋ ਗਿਆ ਜੀ ਅਤੇ ਪੰਜ ਸੌ ਰੁਪਿਆ ਐਕਸਟਰਾ ਲੱਗੇਗਾ ਸਿਰਫ ਔਨਲਾਈਨ ਬੁਕਿੰਗ ਦਾ ਪੱਚੀ ਸੌ ਰੁਪਏ 'ਚ ਤੁਹਾਡਾ ਹੋਜੇਗਾ ਜੀ ਇੱਕ ਦਿਨ ਦਾ ਓਕੇ ਜੀ ਓਕੇ